ਹੈਲੋ ਹੈਲੋ ਹਾਂਜੀ ਮੈਮ ਤੁਸੀਂ ਰਾਹੁਲ ਦੇ ਪਾਪਾ ਔਰ ਮੰਮੀ ਬੋਲ ਰਹੇ ਹੋ ਨਾ ਮੈਮ ਐਕਚੁਲੀ ਨਾ ਰਾਹੁਲ ਦੀ ਤਬੀਅਤ ਬਹੁਤ ਖਰਾਬ ਹੋ ਗਈ ਅਸੀਂ ਉਹਦੇ ਸਕੂਲ ਤੋਂ ਗੱਲ ਕਰ ਰਹੇ ਸੀਗੇ ਹਾਂਜੀ ਅਤੇ ਅਸੀਂ ਇਹ ਕਹਿਣਾ ਸੀ ਕਿ ਤੁਸੀਂ ਬੱਚੇ ਨੂੰ ਜਦੋਂ ਸਵੇਰੇ ਭੇਜਿਆ ਉਹਨੂੰ ਚੈੱਕ ਕਰਕੇ ਨਹੀਂ ਭੇਜਿਆ ਸੀਗਾ ਸਕੂਲ ਨਹੀਂ ਉਹਦੀ ਨਾ ਐਕਚੁਲੀ ਬਹੁਤ ਉਹਨੂੰ ਬੁਖਾਰ ਅਤੇ ਖੰਘ ਜੁਖਾਮ ਬਹੁਤ ਜ਼ਿਆਦਾ ਹੋ ਰੱਖਿਆ ਤਾਂ ਕਰਕੇ ਤੁਸੀਂ ਉਹਨੂੰ ਫਿਰ ਟਾਈਮਲੀ ਆ ਕੇ ਲੈ ਜਿਓ ਕਿਉਂਕਿ ਬੱਚਾ ਫਿਰ ਜ਼ਿਆਦਾਤਰ ਅਸੀਂ ਰੱਖ ਨਹੀਂ ਨਾ ਸਕਦੇ ਅਲਾਉਡ ਨਹੀਂ ਹੈਗਾ ਸਕੂਲ ਦੇ ਵਿੱਚ ਨਹੀਂ ਉਹ ਤਾਂ ਚਲੋ ਕੋਈ ਗੱਲ ਨਹੀਂ ਉਹ ਤਾਂ ਇੰਨਾਂ ਕੁ ਤਾਂ ਅਸੀਂ ਕੇਅਰ ਕਰ ਵੀ ਦੇਵਾਂਗੇ ਪਰ ਤੁਸੀਂ ਬੱਚੇ ਨੂੰ ਆਪਣੇ ਨੂੰ ਟਾਈਮਲੀ ਸਕੂਲ ਤੋਂ ਆ ਕੇ ਲੈ ਜਿਓ ਕਿਉਂਕਿ ਫਿਰ ਹੋਰ ਬੱਚੇ ਵੀ ਬ ਬਿਮਾਰ ਹੋ ਸਕਦੇ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਤੁਸੀਂ ਅੱਗੇ ਬੱਚੇ ਨੂੰ ਬਸ ਟਾਈਮਲੀ ਆ ਕੇ ਲੈ ਜਿਓ ਬਸ ਅੱਗੇ ਬਸ ਅੱਗੇ ਤੋਂ ਪਲੀਜ਼ ਰਿਕੁਐਸਟ ਕਰਦੇ ਹਾਂ ਕਿ ਆਪਣੇ ਬੱਚੇ ਨੂੰ ਨਾ ਪ੍ਰੋਪਰ ਦੇਖ ਕੇ ਭੇਜਿਆ ਕਰੋ ਕਿਉਂਕਿ ਹੋਰ ਬੱਚੇ ਵੀ ਹੁੰਦੇ ਨੇ ਉਹਨਾਂ ਨੂੰ ਵੀ ਖਤਰਾ ਰਹਿੰਦਾ ਹੈ ਨਾ ਬਿਮਾਰੀ ਹੋਣ ਦਾ ਠੰਡ ਦਾ ਮੌਸਮ ਚੱਲ ਰਿਹਾ ਤਾਂ ਕਰਕੇ ਠੀਕ ਹੈ ਫਿਰ ਤੁਸੀਂ ਬਸ ਆ ਕੇ ਟਾਈਮਲੀ ਉਹਨੂੰ ਪਿੱਕ ਕਰ ਲਿਓ ਅਤੇ ਸਾਨੂੰ ਆਉਣ ਤੋਂ ਪਹਿਲਾਂ ਇੱਕ ਵਾਰ ਕੋਲ ਕਰ ਲਿਓ ਕੀ ਸਕੂਲ ਦੀ ਛੁੱਟੀ ਤਿੰਨ ਵਜੇ ਹੁੰਦੀ ਹੈ ਹਾਂਜੀ ਬਸ ਮੈਂ ਬਸ ਤੁਸੀਂ ਜਦੋਂ ਤੁਸੀਂ ਆ ਗਏ ਫਿਰ ਤੁਹਾਨੂੰ ਬੱਚਾ ਲੈ ਕੇ ਜਾਣਾ ਪਏਗਾ ਕਿਉਂਕਿ ਉਰੇ ਫਿਰ ਆਂਟੀ ਵੀ ਕ ਕੰਮ ਵਾਲੇ ਓਹੀ ਕੇਅਰ ਕਰਦੇ ਆ ਬੱਚੇ ਦੀ ਹਾਂਜੀ ਚਲੋ ਠੀਕ ਹੈ ਮੈਮ ਥੈਂਕ ਯੂ ਜੀ